ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਮੈਂ ਮੈਡਮ ਭੁਪਿੰਦਰ ਦੀ ਮੰਮੀ ਬੋਲਦੀ ਪਈ ਹਾਂ ਮੈਡਮ ਮੈਂ ਉਹ ਬੱਚਿਆਂ ਦੇ ਜਿਹੜੇ ਪੇਪਰ ਹੋਏ ਸੀਗੇ ਤਾਂ ਮੈਂ ਇਨ੍ਹਾਂ ਦੇ ਜਦ ਨੰਬਰ ਬਾਰੇ ਪੁੱਛਣਾ ਸੀ ਭੁਪਿੰਦਰ ਨੇ ਕੁਛ ਕੀਤਾ ਚੰਗਾ ਢੰਗ ਨਾਲ ਕਿ ਕਿੱਦਾਂ ਮੈਨੂੰ ਇਹਨਾਂ ਦੇ ਨੰਬਰ ਦੱਸੋਗੇ ਤੁਸੀਂ ਕਿਹੜੇ ਸਬਜੈਕਟ 'ਚ ਕਿੰਨੇ ਨੰਬਰ ਆਏ ਇਹਦੇ ਅੱਛਾ ਜੀ ਅੱਛਾ ਕੀ ਮੈਡਮ ਮੈਥ 'ਚ ਇੰਨੇ ਕਾਹਤੋਂ ਘੱਟ ਗਏ ਇਹਦੇ ਨੰਬਰ ਅਸੀਂ ਤਾਂ ਇਹਨੂੰ ਟਿਊਸ਼ਨ ਵੀ ਰੱਖਿਆ ਆ ਘਰ ਵੀ ਟਿਊਸ਼ਨ ਵੀ ਜਾਂਦਾ ਤੁਹਾਡੇ ਕੋਲ ਵੀ ਪੜ੍ਹਦਾ ਆ ਇੰਨੇ ਨੰਬਰ ਇਹ ਤਾਂ ਬਹੁਤ ਘੱਟ ਹੋ ਗਏ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਉਹ ਮੈਡਮ ਜੀ ਇਹਦਾ ਫਿਰ ਪਾਪਾ ਇਹਨੂੰ ਭੇਜਦੇ ਨਹੀਂ ਵੀ ਛੋਟਾ ਕਰਕੇ ਪੈਸੇ ਗੁਆ ਆਉਗਾ ਜਾਂ ਕਿੱਦਾਂ ਹੈ ਨਾ ਤਾਂ ਇੱਦਾਂ ਉਹ ਦਿੰਦੇ ਨਹੀਂ ਹੈਗੇ ਫਿਰ ਇਹਨਾਂ ਨੂੰ ਬੱਚਿਆਂ ਨੂੰ ਪੈਸੇ ਉਹ ਉਹ ਤਾਂ ਠੀਕ ਹੈ ਮੈਡਮ ਜੀ ਫਿਰ ਅਸੀਂ ਟਿਊਸ਼ਨ ਦੇ ਵੀ ਦਿੰਦੇ ਹੈ ਫਿਰ ਇਹ ਇੰਨੇ ਫਿਰ ਵੀ ਘੱਟ ਨੰਬਰ ਹੈ ਵੀ ਇਹ ਤਾਂ ਫਿਰ ਮ ਇਹਦਾ ਭਾਪਾ ਤਾਂ ਫਿਰ ਬੋਲੇਗਾ ਹਾਂਜੀ